ਹੈਲੋ ਸਤਿ ਸ਼੍ਰੀ ਅਕਾਲ ਵੀਰੇ ਭੋਲਾ ਬੋਲਦਾ ਫਤਿਹਗੜ੍ਹ ਸਾਹਿਬ ਤੋਂ ਠੀਕ ਆ ਵੀਰੇ ਮੈਂ ਨਾ ਹਰਿਆਣੇ ਤੋਂ ਬੋਲਦਾ ਮੈਨੂੰ ਬਲਵਿੰਦਰ ਨੇ ਨੰਬਰ ਦਿੱਤਾ ਸੀ ਤੁਹਾਡਾ ਹਾਂ ਹਾਂ ਹਾਂਜੀ ਵੀਰੇ ਉਹ ਮੈਂ ਨਾ ਜੀ ਫਤਿਹਗੜ੍ਹ ਸਾਹਿਬ ਘੁੰਮਣ ਆਉਣਾ ਮੈਨੂੰ ਦੱਸੋ ਜੀ ਇੱਥੇ ਕੀ ਘੁੰਮਣ ਨੂੰ ਹੈ ਕੁਛ ਵਧੀਆ ਜੇ ਕਦੋਂ ਆਵਾਂ ਜੀ ਸਰ ਓਕੇ ਠੀਕ ਆ ਜੀ ਅੱਛਾ ਉਹ ਵੀ ਉਰੇ ਆ ਜੀ

ਮੈਨੂੰ ਤੁਸੀਂ ਦੱਸੋ ਮੈਂ ਤਾਂ ਫਰੀ ਹਾਂ ਅਸਲ 'ਚ ਮੈਨੂੰ ਇਹ ਆ ਵੀ ਮੈਨੂੰ ਵੱਧ ਜਾਣਕਾਰੀ ਪ੍ਰਾਪਤ ਹੋਵੇ ਮੈਂ ਉਹ ਦਿਨਾਂ 'ਚ ਆਵਾਂ ਅੱਛਾ ਜੀ ਉਦੋਂ ਕੀ ਹੋਇਆ ਸੀ ਓਕੇ ਨਹੀਂ ਪਹਿਲਾਂ ਤਾਂ ਮੈਂ ਸੋਚਦਾ ਸੀ ਇਕੱਲਾ ਆਵਾਂ ਪਰ ਜਦੋਂ ਹੁਣ ਤੁਸੀਂ ਕਿਹਾ ਵੀ ਇੱਥੇ ਸਭਾ ਨੂੰ ਕਾਫ਼ੀ ਜ਼ਿਆਦਾ ਹੁੰਦਾ ਮੈਂ ਚਲੋ ਬੱਚਿਆਂ ਨੂੰ ਵੀ ਲੈ ਹੀ ਜਾਵਾਂ ਵੀ ਉਹ ਵੀ ਬਹਾਨੇ ਨਾਲ਼ ਘੁੰਮ ਜਾਣਗੇ

ਨਹੀਂ ਮੈਂ ਫਿਰ ਟ੍ਰੇਨ ਆਊਗਾ ਜੀ ਟ੍ਰੇਨ ਇੱਥੋਂ ਕਿੰਨੀ ਕੁ ਦੂਰ ਆ ਸਟੇਸ਼ਨ ਨੇੜੇ ਹੀ ਆ ਠੀਕ ਆ ਸਰ ਠੀਕ ਆ ਜੀ ਠੀਕ ਆ ਓਕੇ ਅਤੇ ਮੌਸਮ ਤਾਂ ਉਹ ਠੀਕ ਆ ਵੀ ਮੀਂਹ ਮੂਹ ਵਾਲਾ ਤਾਂ ਨਹੀਂ ਹੈਗਾ ਠੰਡ ਏ ਆ ਬਸ ਹਾਂਜੀ ਠੀਕ ਠੀਕ ਆ ਠੀਕ ਆ ਸਰ ਧੰਨਵਾਦ ਜੀ